ਹੈਲੋ ਕੀ ਤੁਸੀਂ ਬੀ ਐਸ ਐਨ ਐਲ ਦੀ ਗ੍ਰਾਹਕ ਸਹਾਇਤਾ ਤੋਂ ਬੋਲ ਰਹੇ ਹੋ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਮੋਬਾਈਲ ਨੰਬਰ ਏਟ ਫੋਰ ਫੋਰ ਟੂ ਟੂ ਸਿਕਸ ਸੈਵਨ ਏਟ ਫੋਰ ਟੂ 'ਤੇ ਦੋ ਵਾਰ ਰੀਚਾਰਜ ਗਲਤੀ ਨਾਲ ਹੋ ਗਿਆ ਹੈ ਇਸ ਕਰਕੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਹਾਂ ਕਿ ਮੇਰਾ ਇੱਕ ਰਿਚਾਰਜ ਜੋ ਕਿ ਡੁਪਲੀਕੇਟ ਰਿਚਾਰਜ ਹੈ ਉਸ ਨੂੰ ਰੱਦ ਕਰ ਦਿੱਤਾ ਜਾਵੇ ਅਤੇ ਜੋ ਰਕਮ ਹੈ ਉਹ ਮੇਰੇ ਅਕਾਊਂਟ ਵਿੱਚ ਦੁਬਾਰਾ ਭੇਜ ਦਿੱਤੀ ਜਾਵੇ ਮੇਰਾ ਜੋ ਮੋਬਾਇਲ ਨੰਬਰ ਹੈ ਉਹ ਹੈ ਏਟ ਫਾਈਵ ਫੋਰ ਟੂ ਟੂ ਜ਼ੀਰੋ ਸੈਵਨ ਏਟ ਸਿਕਸ ਟੂ ਇਸ ਕਰਕੇ ਇਸ ਈਮੇਲ ਦਾ ਉੱਤਰ ਜਲਦ ਤੋਂ ਜਲਦ ਦੇ ਦਿੱਤਾ ਜਾਵੇ ਤਾਂ ਜੋ ਮੈਂ ਤੁਹਾਨੂੰ ਅਗਲੀ ਜਾਣਕਾਰੀ ਬਾਰੇ ਦੱਸਾਂ ਤੁਹਾਡਾ ਇਸ ਕ ਇਸ ਬਾਰੇ ਕਦਮ ਚੁੱਕਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ